ਮਾਲ ਕਾਰੋਬਾਰ ਕਾਰਪੋਰੇਸ਼ਨਾ ਭਾਈਵਾਲੀ ਜਾਂ ਇਕੱਲੇ ਮਲਕੀਅਤਾਂ ਦੀਆਂ ਕਿਸਮਾਂ ਹਨ ਜਿਨਾਂ ਕੋਲ ਇੱਕ ਨਿਯਮਤ ਅਕਾਰ ਦੇ ਕਾਰੋਬਾਰ ਜਾਂ ਕਾਰਪੋਰੇਸ਼ਨ ਨਾਲੋਂ ਘੱਟ ਕਰਮਚਾਰੀ ਅਤੇ ਜਾਂ ਘੱਟ ਸਲਾਨਾ ਆਮਦਨ ਹੁੰਦੀ ਹੈ ਕਾਰੋਬਾਰਾਂ ਨੂੰ ਸਰਕਾਰੀ ਸਹਾਇਤਾ ਲਈ ਅਰਜੀ ਦੇਣ ਅਤੇ ਤਰਜੀਹੀ ਟੈਕਸ ਨੀਤੀ ਲਈ ਯੋਗ ਹੋਣ ਦੇ ਰੂਪ ਵਿੱਚ ਛੋਟੇ ਵੱਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਯੋਗਤਾਵਾਂ ਦੇਸ਼ ਅਤੇ ਉਦਯੋਗ ਦੇ ਆਧਾਰ ਤੇ ਵੱਖ ਵੱਖ ਹੁੰਦੀਆਂ ਹਨ ਛੋਟੇ ਕਾਰੋਬਾਰ ਆਸਟਰੇਲੀਅਨ ਫੇਅਰ ਵਰਕ ਐਕਟ ਦੋ ਹਜਾਰ ਨੋ ਦੇ ਤਹਿਤ ਪੰਦਰਾ ਕਰਮਚਾਰੀਆਂ ਤੋਂ ਲੈ ਕੇ ਯੂਰਪੀਅਨ ਯੂਨੀਅਨ ਦੁਆਰਾ ਵਰਤੀ ਗਈ ਪਰਿਭਾਸ਼ਾ ਦੇ ਅਨੁਸਾਰ ਪੰਜਾਹ ਕਰਮਚਾਰੀ ਅਤੇ ਕਈ ਹੀ ਯੂ ਐਸ ਸਮਾਲ ਬਿਜਨਸ ਐਡਮਿਨਿਸਟ੍ਰੇਸ਼ਨ ਪ੍ਰੋਗਰਾਮਾਂ ਲਈ ਯੋਗ ਹੋਣ ਅਤੇ ਪੰਜ ਸੋ ਤੋਂ ਘੱਟ ਕਰਮਚਾਰੀ ਹਨ ਹਾਲਾਂਕਿ ਛੋਟੇ ਕਾਰੋਬਾਰਾਂ ਨੂੰ ਤਹਿਤ ਹੋਰ ਤਰੀਕਿਆਂ ਦੇ ਅਨੁਸਾਰ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ ਜਿਵੇਂ ਕਿ ਸਲਾਨਾ ਆਮਦਨ ਸ਼ਿਫਮੈਂਟ ਵਿਕਰੀ ਸੰਪੱਤੀਆਂ ਸਲਾਨਾਕੁਲ ਸ਼ੁੱਧ ਮਾਲੀਆ ਸ਼ੁੱਧ ਲਾਭ ਕਰਮਚਾਰੀਆਂ ਦੀ ਗਿਣਤੀ ਸਭ ਤੋਂ ਵੱਧ ਵਰਤੇ ਜਾਣ ਵਾਲੇ ਉਪਾਵਾਂ ਵਿੱਚੋਂ ਇਕ ਹੈ ਬਹੁਤ ਸਾਰੇ ਦੇਸ਼ਾਂ ਵਿੱਚ ਛੋਟੇ ਕਾਰੋਬਾਰਾਂ ਵਿੱਚ ਸੇਵਾ ਜਾਂ ਪਰਚੂਨ ਸੰਚਾਲਨ ਸ਼ਾਮਿਲ ਹੁੰਦੇ ਹਨ ਜਿਵੇਂ ਕਿ ਸੁਵਿਧਾ ਸਟੋਰ ਬੰਦੂਕ ਦੀਆਂ ਦੁਕਾਨਾਂ ਪੁਰਾਣੀਆਂ ਚੀਜ਼ਾਂ ਦੀਆਂ ਦੁਕਾਨਾਂ ਛੋਟੇ ਕਰਿਆਨੇ ਦੇ ਸਟੋਰ ਵਿਕਰੀ ਜਾਂ ਡੇਲੀ ਕੇਟਸ ਨਾਈ ਹੇਅਰ ਡਰੈਸਰ ਜਾਂ ਵਪਾਰੀ ਕਾਰਡ ਲੀਵਰਸ਼ਿਪ ਲਾਂਡਰਮੈਂਟ ਡਰਾਈ ਕਲੀਨਰ ਮੋਟਰ ਫੋਟੋਗ੍ਰਾਫਰ ਤੇ ਅਤੇ ਕੰਪਿਊਟਰ ਪ੍ਰੋਗਰਾਮਿੰਗ ਕੁਝ ਪੇਸ਼ੇਵਰ ਛੋਟੇ ਕਾਰੋਬਾਰ ਦੇ ਤੌਰ ਤੇ ਕੰਮ ਕਰਦੇ ਹਨ